ਦੌੜਨਾ ਸਿਹਤ ਲਈ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ ਕਿਉਂਕਿ ਦੌੜਨ ਦੇ ਨਾਲ ਸਾਡਾ ਸਰੀਰ ਨਹੀਂ ਅਸੀਂ ਮੈਂਟਲੀ ਵੀ ਮਜਬੂਤ ਹੁੰਦੇ ਹਾਂ ਜਦੋਂ ਅਸੀਂ ਦੌੜ ਰਹੇ ਹੁੰਦੇ ਹਾਂ ਕਿਉਂਕਿ ਅਸੀਂ ਮੋਸਟਲੀ ਜ਼ਿਆਦਾਤਰ ਸਵੇਰ ਦੇ ਸਮੇਂ ਦੌੜਦੇ ਹਾਂ ਪੰਜ ਸਾਢੇ ਪੰਜ ਛੇ ਵਜੇ ਜਿਸ ਵਕਤ ਸੂਰਜ ਚੜ੍ਹ ਰਿਹਾ ਹੁੰਦਾ ਹੈ ਜਿਸ ਨਾਲ ਸਾਨੂੰ ਵਿਟਾਮਿਨ ਡੀ ਦੀ ਵੀ ਭਰਪੂਰ ਮਾਤਰਾ ਮਿਲਦੀ ਹੈ ਜਦੋਂ ਅਸੀਂ ਦੌੜਦੇ ਹਾਂ ਸਾਡੀ ਹਾਰਟਬੀਟ ਇੱਕ ਸੌ ਵੀਹ ਪਲੱਸ ਹੁੰਦੀ ਹੈ ਇੱਕ ਸੌ ਵੀਹ ਇੱਕ ਮਿੰਟ ਦੇ ਵਿੱਚ ਇੱਕ ਸੌ ਵੀਹ ਵਾਰ ਦਿਲ ਧੜਕਦਾ ਹੈ ਅਤੇ ਸਾਡੇ ਸਾਡੇ ਫੇਫੜੇ ਆ ਉਹ ਲੋੜ ਤੋਂ ਜ਼ਿਆਦਾ ਓਕਸੀਜਨ ਸੋਖ ਰਹੇ ਹੁੰਦੇ ਹਨ ਅਤੇ ਸਵੇਰ ਦੇ ਸਮੇਂ ਜਿਹੜੀ ਹਵਾ ਉਹ ਬਹੁਤ ਸ਼ੁੱਧ ਹੁੰਦੀ ਹੈ ਜੋ ਕਿ ਸਾਡੇ ਫੇਫੜਿਆਂ ਤੱਕ ਪਹੁੰਚਦੀ ਹੈ ਸਾਡੇ ਖੂਨ ਦੇ ਸਰਕਲ ਨੂੰ ਵਧਾਉਂਦੀ ਹੈ ਅਤੇ ਇਸ ਨਾਲ ਮਾਸਪੇਸ਼ੀਆਂ ਵੀ ਮਜ਼ਬੂਤ ਹੁੰਦੀਆਂ ਹਨ ਜਦੋਂ ਅਸੀਂ ਦੌੜ ਰਹੇ ਹਨ ਦੌੜ ਰਹੇ ਹੁੰਦੇ ਹਾਂ ਸਾਡੀਆਂ ਲੱਤਾਂ ਦੀਆਂ ਮਾਸਪੇਸ਼ੀਆਂ ਅਤੇ ਸਾਡੇ ਜੋਆਇੰਟਸ ਸਾਡੀਆਂ ਬਾਹਾਂ ਸਾਡੇ ਹਰ ਇੱਕ ਕਿਉਂਕਿ ਦੌੜਨ ਦੇ ਵਿੱਚ ਅਜਿਹਾ ਕੋਈ ਵੀ ਅੰਗ ਨਹੀਂ ਹੈਗਾ ਜਿਹੜਾ ਕੰਮ ਨਾ ਕਰਦਾ ਹੋਵੇ ਲੱਤਾਂ ਤੋਂ ਲੈ ਕੇ ਪੈਰਾਂ ਤੱਕ ਸੋਰੀ ਲੱਤਾਂ ਤੋਂ ਲੈ ਕੇ ਸਿਰ ਤੱਕ ਸਾਡਾ ਇਕੱਲਾ ਇਕੱਲਾ ਓਰਗਨ ਉਹ ਹਰਕਤ ਵਿੱਚ ਹੁੰਦਾ ਹੈ ਗਾ ਸਾਡੀਆਂ ਅੱਖਾਂ ਸਾਡੇ ਕੰਨ ਸਾਡਾ ਮੂੰਹ ਹਵਾ ਲੈ ਰਿਹਾ ਹੁੰਦਾ ਹੈ ਨੱਕ ਛੱਡ ਰਿਹਾ ਹੁੰਦਾ ਹੈ ਸਾਡੇ ਦਿਲ ਸਾਡੇ ਫੇਫੜੇ ਹਰ ਇੱਕ ਅੰਗ ਸਾਡਾ ਪੂਰੀ ਹਰਕਤ ਵਿੱਚ ਹੁੰਦੇ ਹੈ ਇਸਦੇ ਜੇ ਦੋੜਨ ਦੇ ਨਾਲ ਦਿਲ ਦੀ ਦਿਨ ਦੀ ਸ਼ੁਰੂਆਤ ਕੀਤੀ ਜਾਵੇ ਤਾਂ ਇਹ ਇਸ ਤੋਂ ਵੱਡਾ ਮਜ਼ਾ ਜ਼ਿੰਦਗੀ ਵਿੱਚ ਹੋਰ ਕੋਈ ਨਹੀਂ ਹੈਗਾ ਜੇਕਰ ਤੁਸੀਂ ਦੌੜ ਰਹੇ ਹੁੰਦੇ ਹੋ ਦੌੜ ਕੇ ਹੱਟਦੇ ਹੋ ਘਰੇ ਆਉਂਦੇ ਹੋ ਕੈਲਰੀ ਤੁਹਾਡੀਆਂ ਬਰਨ ਹੁੰਦੀਆਂ ਨੇ ਤਾਂ ਤੁਹਾਡੇ ਵਿੱਚ ਇੱਕ ਨਵਾਂ ਮੋਟੀਵੇਸ਼ਨ ਆਉਂਦੀ ਹੈ ਕਿ ਤੁਸੀਂ ਦਿਨ ਭਰ ਫਰੈਸ਼ ਫੀਲ ਕਰਦੇ ਹੋ ਇਕਦਮ ਤੁਹਾਨੂੰ ਕੋਈ ਵੀ ਕੰਮ ਦਿੱਤਾ ਜਾਵੇ ਚੁਣੌਤੀ ਦਿੱਤੀ ਜਾਵੇ ਤੁਸੀਂ ਇੱਕ ਮਿੰਟ ਦੇ ਅੰਦਰ ਉਸਨੂੰ ਹੱਸ ਕੇ ਪੂਰਾ ਕਰਦੇ ਹੋ ਤੁਹਾਡੇ ਵਿੱਚ ਚੁਸਤੀ ਆਉਂਦੀ ਹੈ ਤੁਹਾਡੇ ਵਿੱਚ ਨੇਸਤੀ ਨਹੀਂ ਆਉਂਦੀ ਇਹ ਸਭ ਤੋਂ ਵੱਡਾ ਕਾਰਨ ਹੈ ਤੋ ਮੇਰਾ ਖਿਆਲ ਹੈ ਵੀ ਦੌੜਨਾ ਚਾਹੀਦਾ ਜਿਹੜੇ ਵਿਅਕਤੀ ਦੌੜ ਨਹੀਂ ਸਕਦੇ ਉਹ ਚੱਲਣ ਤੋਂ ਸ਼ੁਰੂਆਤ ਕਰ ਸਕਦੇ ਨੇ ਅਤੇ ਹੌਲੀ ਹੌਲੀ ਉਹ ਦੌੜਨਗੇ ਵੀ